ਪੰਜਾਬ ਦਾ ਖੇਡ ਖੇਤਰ ਲਿੰਗ ਸਮਾਨਤਾ ਲਈ ਕਈ ਉਪਰਾਲੇ ਕਰਦਾ ਹੈ ਅਤੇ ਇਸ ਲਈ ਕਈ ਸਹੂਲਤਾਂ ਪ੍ਰਦਾਨ ਕਰਦਾ ਹੈ ਜਿਵੇਂ ਕਿ ਹੌਕੀ ਅਤੇ ਕਬੱਡੀ ਦੀਆਂ ਟੀਮਾਂ ਵਿੱਚ ਔਰਤਾਂ ਲਈ ਪਹਿਲੇ ਤੋਂ ਰਿਜ਼ਵਰਡ ਸੀਟਾਂ ਹੁੰਦੀਆਂ ਹਨ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਇਸ ਮੁੱਦੇ ਨੂੰ ਹੱਲ ਕੀਤਾ ਗਿਆ ਹੈ ਖੇਡ ਖੇਤਰ ਦੁਆਰਾ